ਸਾਡੇ ਦੇਸ਼ ਫਿਰੋਜਪੁਰ ਸ਼ਹਿਰ ਦੇ ਵਿੱਚ ਹਰੀ ਕਾ ਪੱਤਣ ਹੈ ਉਹਦੇ ਵਿੱਚ ਅਲੱਗ ਅਲੱਗ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਅਲੱਗ ਅਲੱਗ ਪਤਨਾਂ ਤੋਂ ਪੰਛੀ ਆਂਦੇ ਹਨ ਇੱਕ ਇੱਕ ਵਰੀ ਮੈਨੂੰ ਵੀ ਮੌਕਾ ਮਿਲਿਆ ਪੰਛੀ ਦੇਖਣ ਦਾ ਤੇ ਓਥੇ ਅਲੱਗ ਅਲੱਗ ਤਰ੍ਹਾਂ ਦੇ ਅਲੱਗ ਅਲੱਗ ਦੇਸ਼ਾਂ ਤੋਂ ਪੰਛੀ ਰੰਗ ਬਿਰੰਗੇ ਆਂਦੇ ਹਨ ਤੇ ਬੜੇ ਹੀ ਖੂਬਸੂਰਤ ਲੱਗਦੇ ਹਨ ਤੇ ਮੈਂ ਵੀ ਉਨ੍ਹਾਂ ਨੂੰ ਦੇਖਣ ਗਈ ਆਪਣੇ ਬੱਚਿਆਂ ਨੂੰ ਨਾਲ਼ ਲੈ ਕੇ ਮੇਰੇ ਬੱਚਿਆਂ ਨੇ ਬਹੁਤ ਪਸੰਦ ਕੀਤਾ ਉਨ੍ਹਾਂ ਨੂੰ ਤੇ ਅਸੀਂ ਸਾਰੇ ਜਣੇ ਦੇਖਣ ਗਏ ਸੀਗੇ ਤੇ ਮੇਰੇ ਮੇਰਾ ਘਰਵਾਲਾ ਵੀ ਨਾਲ਼ ਗਿਆ ਸੀਗਾ ਅਸੀਂ ਸਾਰੇ ਮੇਰੇ ਬੱਚੇ ਮੇਰੇ ਸੱਸ ਮੇਰਾ ਸੋਹਰਾ ਅਸੀਂ ਸਾਰੇ ਦੇਖਣ ਗਏ ਤੇ ਹਰੀ ਕੇ ਪੱਤਣ ਵਿੱਚ ਫ਼ਿਰੋਜ਼ਪੁਰ ਸਾਰੇ ਜਣੇ ਅਸੀਂ ਦੇਖ ਕੇ ਆਏ ਉਨ੍ਹਾਂ ਨੂੰ ਤੇ ਉਹ ਅਲੱਗ ਅਲੱਗ ਤਰ੍ਹਾਂ ਦੇ ਸੀਗੇ ਕੋਈ ਕਿਤੇ ਕਿਸੇ ਦੇਸ਼ ਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਬੜੇ ਪਸੰਦ ਸਾਨੂੰ ਸਾਰਿਆਂ ਨੂੰ ਬੜੇ ਪਸੰਦ ਆਏ ਪੰਛੀਆਂ ਨੂੰ ਅਜ਼ਾਦ ਹੀ ਕਰ ਦੇਣਾ ਚਾਈਦਾ ਹੈ ਕਿਉਂਕੀ ਉਹ ਆਪਣਾ ਉੱਡਦੇ ਰਹਿਣ ਉਹ ਉੱਡਦੇ ਹੀ ਸੋਹਣੇ ਲੱਗਦੇ ਹਨ ਉਨ੍ਹਾਂ ਨੂੰ ਬੰਨ ਕੇ ਰੱਖਣਾ ਨਹੀਂ ਚਾਈਦਾ ਉਹ ਬਹੁਤ ਪਿਆਰੇ ਲੱਗਦੇ ਨੇ ਜਦੋਂ ਉੱਡਦੇ ਨੇ ਤੇ ਆਪਣਾ ਆਪਣਾ ਵੱਖ ਵੱਖ ਦੇਸ਼ਾਂ ਤੋਂ ਆਉਂਦੇ ਹਨ ਹਰੀ ਕੇ ਪੱਤਣ ਵਿੱਚ ਤੇ ਬਹੁਤ ਪਿਆਰੇ ਲੱਗਦੇ ਲੋਕੀਂ ਦੂਰੋਂ ਦੂਰੋਂ ਉਨ੍ਹਾਂ ਨੂੰ ਦੇਖਣ ਆਂਦੇ ਹਨ ਤੇ ਸਾਰੇ ਜਣੇ ਉਨ੍ਹਾਂ ਨੂੰ ਦੇਖਣ ਜਾਂਦੇ ਹਨ ਛੁੱਟੀਆਂ ਵਿੱਚ ਬੱਚਿਆਂ ਨੂੰ ਲੈ ਕੇ ਸਾਰੇ ਜਾਂਦੇ ਹਨ ਧੰਨਵਾਦ